ਹੈਲੋ ਸੁਖਦੀਪ ਜੀ ਬੋਲ ਰਹੇ ਸੁਖਦੀਪ ਜੀ ਮੈਨੂੰ ਦਵਿੰਦਰ ਜੀ ਨੇ ਤੁਹਾਡਾ ਨੰਬਰ ਦਿੱਤਾ ਸੀ ਜੀ ਹਾਂਜੀ ਸਰ ਮੈਂ ਨਾ ਨਵਾਂ ਘਰ ਬਣਾਇਆ ਹੈਗਾ ਤੇ ਉਹਦੇ ਚ ਇਲੈਕਟਰੀਕਲ ਦੀ ਫਿਟਿੰਗ ਦੇ ਬਾਰੇ ਸਮਾਨ ਵਗੈਰਾ ਚਾਹੀਦਾ ਸੀ ਉਹਦੀ ਗੱਲ ਕਰਨੀ ਸੀ ਹਾਂਜੀ ਸਰ ਸਾਰਾ ਸਾਰ ਇਲੈਕਟਰੀਕਲ ਦੀ ਫਿਟਿੰਗ ਦਾ ਸਾਰਾ ਸਮਾਨ ਚਾਹੀਦਾ ਜੀ ਤੇ ਤੁਸੀਂ ਸਰ ਇੱਕ ਹੋਰ ਚੀਜ਼ ਮੈਨੂੰ ਦੱਸਿਓ ਤੁਸੀਂ ਕੱਠਾ ਕੋਂਟਰੈਕਟ ਵੀ ਲੈ ਲੈਂਦੇ ਹੋ ਜਾਂ ਸਿਰਫ ਸਮਾਨ ਦੀ ਸਪਲਾਈ ਹੀ ਕਰਦੇ ਹੋ ਫਿਟਿੰਗ ਵਗੈਰਾ ਤੇ ਇਹ ਕਰ ਦਿੰਦੇ ਹੋ

ਓਕੇ ਤੇ ਸਰ ਆਪਣੇ ਕਿਹੜੀ ਕੰਪਨੀ ਦੇ ਮਤਲਬ ਸਮਾਨ ਮਿਲ ਜਾਏਗਾ ਹੈ ਹੈਵਲ ਹੈਵਲਸ ਦਾ ਸਰ ਮਿਲ ਜਾਏਗਾ ਓਕੇ ਹਾਂਜੀ ਠੀਕ ਹ ਸਰ ਤੇ ਸਰ ਫਿਰ ਆਪਣੇ ਜਿਹੜਾ ਆਪਣੇ ਆਈਡੀਆ ਕਿੰਨਾ ਕ ਹੋਏਗਾ ਕਿ ਆਪਣਾ ਹੈਗਾ ਜੀ ਦਸ ਮਰਲੇ ਦਾ ਕੋਠੀ ਹੈ ਜੀ ਤੇ ਉਹਦੇ 'ਚ ਕਵਰਡ ਹਾਂਜੀ ਕਮਰੇ ਆਪਣੇ ਹੈਗੇ ਸਰ ਤਿੰਨ ਕਮਰੇ ਬਣਾਏ ਜੀ ਕਿਚਨ ਬਾਥਰੂਮ ਦੋ ਬਾਥਰੂਮ ਨੇ ਗਰਾਊਂਡ ਫਲੋਰ ਤੇ ਉੱਪਰ ਅਸੀਂ ਬਣਾਇਆ ਨਹੀਂ ਹੈ ਸਰ ਹਾਂਜੀ ਸਿੰਗਲ ਸਟੋਰੀ ਹੈਗੀ ਆ ਜੀ ਤਿੰਨ ਕਮਰੇ ਨੇ ਇਕ ਕਿਚਨ ਆ ਦੋ ਵਾਸ਼ਰੂਮ ਨੇ ਤੇ ਇੱਕ ਸਟੋਰ ਹੈ ਇੱਕ ਪੂਜਾ ਰੂਮ ਹੈ ਸਰ ਉਹ ਤੁਸੀਂ ਇੱਕ ਇਦਾਂ ਕਈ ਆ ਅਸੀਂ ਤਾਂ ਹੁਣ ਦੇਖੋ ਅਸੀਂ ਤਾਂ ਸੋਚਿਆ ਹੀ ਆ ਹੁਣ ਤੁਸੀਂ ਯਾਂ ਕਿਸੇ ਬੰਦੇ ਨੂੰ ਭੇਜ ਦਿਓ ਜਿਹੜਾ ਉਥੇ ਆ ਕੇ ਸਾਰਾ ਮਈਅਰਮੈਂਟ ਲੈ ਲਵੇ ਤੇ ਆਪਣਾ ਉਹ ਐਕਟੀਮੇਟ ਵੀ ਦੱਸ ਦਵੇ ਕਿੰਨਾ ਕ ਬਣੇਗਾ ਹਾਂਜੀ ਮੜਾ ਜਿਹਾ ਇਹ ਕਮਰਿਆਂ ਦੇ ਹਿਸਾਬ ਨਾਲ ਦੱਸ ਦਿਓ ਕਿਉਂਕਿ ਇਨਾ ਹੀ ਹੈਗਾ ਆਪਣਾ ਹਾਂਜੀ ਆਪਾਂ ਸਰ ਸਮਾਨ ਬਸ ਇਨਾ ਧਿਆਨ ਰੱਖਿਓ ਸਰ ਸਮਾਨ ਸਾਨੂੰ ਹੈਵਲਸ ਹੀ ਚਾਹੀਦਾ ਸਾਰਾ ਉਹਦੇ ਚ ਸਵਿ ਸਵਿਚਸ ਹੋ ਗਏ ਟਿਊਬ ਰੋਡਸ ਹੋ ਗਈਆਂ ਜਾਂ ਬਲਬ ਜਿਹੜੇ ਵੀ ਹੋਵੇ ਐਲਈਡੀ ਹੋਗੇ ਤਾਰਾਂ ਵਗੈਰਾ ਹੋ ਗਈਆਂ ਸਾਰਾ ਕੁਝ ਵਿੱਚੇ ਚਾਹੀਦਾ ਜੀ ਤੇ ਸਰ ਪੱਖਿਆਂ ਦੇ ਜਿਹੜੇ ਮਾਡਲ ਹੈਗੇ ਨੇ ਉਹ ਆਪਣੇ ਕੋਲ ਰਿਮੋਟ ਵਾਲੇ ਹੈਗੇ ਨੇ ਅੱਛਾ ਓਕੇ ਰਾਈਟ ਸਰ ਰਾਈਟ

ਅੱਛਾ ਜੀ ਅੱਛਾ ਜੀ

ਗੇੜ ਤੇ ਅੱਛਾ ਬਾਕੀ ਸਰ ਜੇ ਬੈਟਰ ਜੇ ਹੋਏਗਾ ਜੇ ਤੁਸੀਂ ਆਪਣਾ ਕਿਸੇ ਐਕਸਪਰਟ ਨੂੰ ਭੇਜਦੇ ਹੋ ਤੇ ਉਹ ਥੋੜਾ ਐਸਟੀਮੇਟ ਲਗਾ ਕੇ ਫਿਰ ਤੁਹਾਨੂੰ ਦੱਸ ਦੇਵੇ ਹਾਂਜੀ ਸਰ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਹੋਣਾ ਸੇਵ ਕਰ ਲਿਓ ਇਸੇ ਨੰਬਰ ਤੇ ਮੈਨੂੰ ਲੋਕੇਸ਼ਨ ਭੇਜ ਦਿਓ ਆਪਣੀ ਤੇ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਭੇਜ ਦਿਆਂਗਾ ਦੋਨੋਂ ਸ਼ੇਅਰ ਕਰ ਦਿੰਨੇ ਆ ਆਪਣੀ ਲੋਕੇਸ਼ਨ ਤੇ ਹਾਂਜੀ ਹਾਂਜੀ ਹਾਂਜੀ ਦਵਿੰਦਰ ਜੀ ਨੇ ਦੱਸਿਆ ਸੀ ਕਹਿੰਦੇ ਉਹਨਾਂ ਨੇ ਵੀ ਤੁਹਾਡੇ ਉਹਨਾਂ ਨੇ ਵੀ ਤੁਸੀਂ ਹੀ ਕੰਮ ਕੀਤਾ ਸੀ ਸਪਲਾਈ ਤੁਸੀਂ ਕੀਤੀ ਮੈਂ ਕਿਹਾ ਚਲੋ ਮੈਨੂੰ ਵਧੀਆ ਲੱਗਾ ਸੀ ਤੁਹਾਡਾ ਕੰਮ ਸਰ ਹਾਂਜੀ ਹਾਂਜੀ ਥੈਂਕਯੂ ਸਰ ਥੈਂਕਯੂ ਜੀ